ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਿੰਧੀ ਸਵੀਟਸ ਤੋਂ ਗੱਲ ਕਰ ਰਹੇ ਓਂ ਸਰ ਮੈਂ ਜਿਹੜੇ ਹੈ ਹੋਮ ਡਿਲਵਰੀ ਕਰਵਾਉਣਾ ਚਾਹੁੰਦੀ ਹਾਂ ਮੇਰੇ ਜਿਹੜੇ ਰਿਸ਼ਤੇਦਾਰ ਹੈ ਕੱਲ੍ਹ ਮਿਤੀ ਜਿਹੜੀ ਹੈਗੀ ਹੈ ਚਾਰ ਤਰੀਕ ਨੂੰ ਆਉਣਾ ਚਾਹ ਰਹੇ ਆ ਰੱਖੜੀ ਦਾ ਜਿਹੜਾ ਫੰਕਸ਼ਨ ਸੀਗਾ ਉਤੋਂ ਬਾਅਦ ਜਿਹੜੇ ਹੈਗੇ ਆ ਆਪਾਂ ਕਰ ਰਹੇ ਖਾਣਾ ਪੀਣਾ ਕਰ ਰਹੇ ਹਾਂ ਪ੍ਰੋਗਰਾਮ ਉਹਨਾਂ ਦਾ ਕਿਆ ਫੈਸੇਲਿਟੀ ਤੁਸੀਂ ਜਲਦੀ ਤੋਂ ਜਲਦੀ ਦੇ ਦੋਂਗੇ ਸਾਨੂੰ ਜਿਹੜਾ ਹੈਗਾ ਏ ਇਹਦੇ ਵਿੱਚ ਚਾਹੀਦੇ ਨੇ ਛੋਲੇ ਭਟੂਰੇ ਮਿਕਸ ਵੈੱਜ ਕੜਾਹੀ ਪਨੀਰ ਦਾਲ ਮੱਖਣੀ ਚਾਵਲ ਰਾਇਤਾ ਤੰਦੂਰੀ ਰੋਟੀ ਲੱਛਾ ਪਰਾਂਠਾ ਔਰ ਇਹਦੇ ਨਾਲ਼ ਤੁਸੀਂ ਮਿੱਠੇ ਵਿੱਚ ਕਰ ਦਿਓ ਰਸ ਮਲਾਈ ਰਸ ਮਲਾਈ ਦੀ ਚਾਰ ਪਲੇਟਾਂ ਕਰ ਦਿਓ ਗੁਲਾਬ ਜਾਮਣ ਜਿਹੜੇ ਹੈਗੇ ਐਂ ਉਹ ਅੱਠ ਪੀਸ ਕਰ ਦਿਓ ਆਈਸ ਕਰੀਮ ਦਾ ਇੱਕ ਕਿਲੋ ਦਾ ਡੱਬਾ ਕਰ ਦਿਓ ਇਹ ਜਿਹੜਾ ਹੈਗਾ ਸਾਨੂੰ ਕੱਲ੍ਹ ਨੂੰ ਚਾਹੀਦੀ ਹੈ ਚਾਰ ਤਰੀਕ ਨੂੰ ਚਾਹੀਦੀ ਹੈ ਜਲਦੀ ਤੋਂ ਜਲਦੀ ਚੰਗੀ ਤਰ੍ਹਾਂ ਅਤੇ ਜਿਹੜਾ ਹੈਗਾ ਅੱਛੀ ਸਫਾਈ ਨਾਲ਼ ਇਹਦਾ ਪੈਕ ਕਰਕੇ ਦੇ ਦਿਓ ਸਾਨੂੰ ਔਰ ਮੇਰੀ ਰਿਕੁਐਸਟ ਕਿ ਜੇ ਤੁਸੀਂ ਡਿਸਕਾਊਂਟ ਕਰਦੋਂ ਤਾਂ ਬਹੁਤ ਵਧੀਆ ਗੱਲ ਹੋਵੇਗੀ ਕਿਉਂਕਿ ਤੁਹਾਡੇ ਅੱਛੇ ਅਸੀਂ ਕਸਟਮਰ ਐਂ ਕਾਫ਼ੀ ਲੰਬੇ ਟਾਈਮ ਤੋਂ ਤੁਹਾਡੇ ਨਾਲ਼ ਜੁੜੇ ਹੋਏ ਐਂ